ਪਹਿਲਾਂ ਸਾਡੇ ਪੇਂਡੂ ਖੇਤਰ ਵਿੱਚ ਬਹੁਤ ਸਾਰੀਆਂ ਖੇਡਾਂ ਖੇਡਦੇ ਸਨ ਬਾਹਰ ਜਾ ਕੇ ਸਾਰਿਆਂ ਨਾਲ ਰਲ ਮਿਲ ਕੇ ਖੇਡਦੇ ਸਨ ਪਰ ਅੱਜ ਕੱਲ੍ਹ ਟੈਕਨੋਲੋਜੀ ਦਾ ਜਮਾਨਾ ਆ ਗਿਆ ਹੈ ਇਸ ਵਿੱਚ ਬੱਚੇ ਕਿਸੇ ਨਾਲ ਤਾਲਮੇਲ ਨਹੀਂ ਰੱਖਦੇ ਹਨ ਬੱਚੇ ਸਮਾਰਟਫੋਨ ਉੱਤੇ ਹਮੇਸ਼ਾ ਉੱਤੇ ਗੇਮਾਂ ਖੇਡਦੇ ਹਨ ਜਾਂ ਕੁਝ ਨਾ ਕੁਝ ਦੇਖਦੇ ਰਹਿੰਦੇ ਹਨ ਬਾਹਰ ਦੀਆਂ ਜਾਂ ਅੰਦਰ ਖੇਡਣ ਵਾਲੀਆਂ ਖੇਡਾਂ ਨੂੰ ਛੱਡ ਕੇ ਸਕਰੀਨ 'ਤੇ ਖੇਡੀਆਂ ਜਾਣ ਵਾਲੀਆਂ ਖੇਡਾਂ ਖੇਡਦੇ ਹਨ ਇਸ ਨਾਲ ਬੱਚੇ ਦਾ ਸਰੀਰਕ ਵਿਕਾਸ ਰੁਕਦਾ ਜਾ ਰਿਹਾ ਹੈ ਸਮਾਜ ਨਾਲ ਕੋਈ ਤਾਲਮੇਲ ਨਹੀਂ ਹੈ ਬੱਚੇ ਆਪਣੇ ਆਪ ਵਿੱਚ ਮਸਤ ਰਹਿੰਦੇ ਹਨ ਬੱਚਿਆਂ ਵਿੱਚ ਐਨਕਾਂ ਲੱਗ ਚੁੱਕੀਆਂ ਹਨ ਅਤੇ ਤਣਾਅ ਵਿੱਚ ਰਹਿੰਦੇ ਹਨ ਸਾਨੂੰ ਬੱਚਿਆਂ ਨੂੰ ਬਾਹਰ ਦੀਆਂ ਖੇਡਾਂ ਖੇਡਣ ਲਈ ਪ੍ਰੇਰਿਤ ਕਰਨ ਲਈ ਪ੍ਰੇਰਿਤ ਕਰਨਾ ਚਾਹੀਦਾ ਹੈ ਖੇਡਾਂ ਵਿੱਚ ਮੌਕੇ ਦਿੱਤੇ ਜਾਣੇ ਚਾਹੀਦੇ ਹਨ ਸਕੂਲਾਂ ਵਿੱਚ ਮੁਕਾਬਲੇ ਕਰਵਾਉਣੇ ਚਾਹੀਦੇ ਹਨ ਖੇਡਾਂ ਖੇਡਣ ਵਾਲਿਆਂ ਨੂੰ ਇਨਾਮ ਵੀ ਦਿੱਤੇ ਜਾਣੇ ਚਾਹੀਦੇ